ਮੈਨੂੰ ਕਲਾ ਕਰਨੀ ਬਹੁਤ ਪਸੰਦ ਹੈ ਅਤੇ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਮਤਲਬ ਬਹੁਤ ਸਾਰੀਆਂ ਡਰਾਇੰਗਾਂ ਬਣਾਈਆਂ ਹਨ ਅਤੇ ਮੈਂ ਆਪਣੇ ਸਕੂਲ 'ਚ ਵੀ ਮਤਲਬ ਬਹੁਤ ਸਾਰੇ ਡਰਾਇੰਗ ਇੱਦਾਂ ਦੇ ਮਤਲਬ ਕੰਮ ਮਤਲਬ ਜਿੱਤੇ ਆ ਹੋਰ ਕੋਈ ਸਕੂਲਾਂ ਦੇ ਵਿੱਚ ਜਾ ਕੇ ਪਾਰਟੀਸਪੇਟ ਕਰਕੇ ਮਤਲਬ ਇੱਦਾਂ ਦੀ ਬਹੁਤ ਟਰੋਫੀ ਜਿੱਤੀਆਂ ਹਨ ਆਰਟ ਦੇ ਵਿੱਚ ਅਤੇ ਮਤਲਬ ਹੁਣ ਮੈਂ ਸਕੂਲ ਜਾਂਦਾ ਏ ਅਤੇ ਸਕੂਲ ਦੇ ਵਿੱਚ ਮਤਲਬ ਇੰਨਾਂ ਮਤਲਬ ਆਪਣੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਦਿੰਦਾ ਐਂ ਕਿਉਂਕਿ ਮੇਰੀ ਬੋਰਡ ਦੀ ਕਲਾਸ ਹੈ ਅਤੇ ਮਤਲਬ ਜ਼ਿਆਦਾਤਰ ਅਗਰ ਜੇ ਮੈਂ ਵਿਹਲਾ ਤਾਂ ਹੁੰਦਾ ਨਹੀਂ ਹੈ ਪਰ ਅਗਰ ਜੇ ਕਈ ਵਾਰੀ ਮੈਨੂੰ ਕੰਮ ਘੱਟ ਹੁੰਦਾ ਏ ਜੇਕਰ ਮੈਨੂੰ ਲੱਗਦਾ ਹੈ ਕਿ ਮੈਂ ਥੋੜ੍ਹਾ ਜਿਹਾ ਟਾਈਮ ਹੈਗਾ ਮੇਰੇ ਕੋਲ ਤਾਂ ਮੈਂ ਆਪਣੇ ਡਰਾਇੰਗ ਦੀਆਂ ਯੂਟਿਊਬ ਦੇ ਉੱਪਰ ਵੀਡੀਓ ਦੇਖ ਲੈਂਦਾ ਏ ਪਰ ਮੈਂ ਮਤਲਬ ਬਣਾਉਂਦਾ ਨਹੀਂ ਹੈਗਾ ਪਹਿਲਾਂ ਵਾਂਗੂੰ ਪਰ ਅਗਰ ਜੇ ਮੈਨੂੰ ਮਤਲਬ ਕਦੇ ਬਣਾਉਣੀ ਪਈ ਮਤਲਬ ਕਿਸੇ ਨੂੰ ਦੇਣ ਵਾਸਤੇ ਅਤੇ ਕੋਈ ਵੀ ਕੰਮ ਵਾਸਤੇ ਕਿਸੇ ਨੂੰ ਮਤਲਬ ਕਿਸੇ ਨੂੰ ਅਰਜੈਂਟਲੀ ਚਾਹੀਦੀ ਹੋਵੇ ਤਾਂ ਮੈਂ ਬਣਾ ਸਕਦਾ ਏ ਪਰ ਮਤਲਬ ਇੰਨਾਂ ਹੈ ਕਿ ਹੁਣ ਮੈਂ ਮਤਲਬ ਆਪਣੇ ਬੋਰਡ ਦੀ ਕਲਾਸ ਕਰਕੇ ਮਤਲਬ ਇੱਦਾਂ ਪੇਂਟਿੰਗ ਮਤਲਬ ਪਹਿਲਾਂ ਵਾਂਗੂੰ ਬਣਾਉਂਦਾ ਨਹੀਂ ਹੈਗਾ ਬਹੁਤ ਜ਼ਿਆਦਾ ਘੱਟ ਬਣਾਉਂਦਾ ਏ ਅਤੇ ਮਤਲਬ ਅਗਰ ਜੇ ਮੈਂ ਦੇਖਣੀ ਹੋਵੇ ਤਾਂ ਯੂਟਿਊਬ ਦੇ ਉੱਪਰ ਮੈਂ ਵੀਡੀਓ ਦੇਖ ਲੈਂਦਾ ਪਰ ਮਤਲਬ ਹੁਣ ਮੈਂ ਬਹੁਤ ਘੱਟ ਹੀ ਵੀਡੀਓ ਬਣਾਉਂਦਾ ਮੇਰੀ ਆਪਣੀ ਬੋਰਡ ਦੀ ਕਲਾਸ ਕਰਕੇ